ਪੇਂਟਿੰਗ ਰਾਹੀਂ ਮੈਂ ਦੂਜਿਆਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹਾਂ ਕਿ ਮੈਂ ਇਹੋ ਜਿਹਾ ਸੇਮ ਬਣਾਉਂਦੀ ਹਾਂ ਜਿਸ ਰਾਹੀਂ ਲੋਕ ਆਕਰਸ਼ਿਤ ਹੁੰਦੇ ਹਨ ਅਤੇ ਆਪਣੇ ਆਪ ਨੂੰ ਇਸ ਮੁਤਾਬਿਕ ਆਪਣੀ ਸਿਚੁਏਸ਼ਨ ਨੂੰ ਰੱਖਦੇ ਹਨ ਜਿਵੇਂ ਕਿ ਮੈਂ ਇੱਕ ਖੇਤੀ ਦਾ ਸੀਨ ਬਣਾਇਆ ਇੱਕ ਕਿਸਾਨ ਖੇਤੀ ਕਰ ਰਿਹਾ ਹੁੰਦਾ ਹੈ ਉਸ ਦੇ ਆਲੇ ਦੁਆਲੇ ਦਾ ਸਾਰਾ ਵਾਤਾਵਰਨ ਉਸਦੇ ਮੁਤਾਬਿਕ ਸੀ ਜਦੋਂ ਕਿ ਮੈਂ ਇਹ ਮੇਰੀ ਪਰਸਤੁਤੀ ਲੋਕਾਂ ਅੱਗੇ ਰੱਖਦੀ ਹਾਂ ਤਾਂ ਲੋਕ ਆਪਣੇ ਆਪ ਨੂੰ ਉਸ ਪ੍ਰਸਤੁਤੀ ਨੂੰ ਜੋੜਦੇ ਹਨ ਅਤੇ ਆਪਣੇ ਆਪ ਨੂੰ ਉਸ ਮੁਤਾਬਿਕ ਤਾਲ ਦੇ ਹਨ ਕਿ ਅਸੀਂ ਉਸ ਜਗ੍ਹਾ ਖੜ੍ਹੇ ਹੁੰਦੇ ਤਾਂ ਸਾਡੇ ਆਲੇ ਦੁਆਲੇ ਤੋਂ ਵਾਤਾਵਰਨ ਵੀ ਇਹਾ ਜਿਹਾ ਹੋਣਾ ਸੀ